ਹੈਲੋ ਨਮਸਕਾਰ ਜੀ ਮੈਂ ਨਰੇਸ਼ ਕੁਮਾਰ ਬੋਲ ਰਿਹਾ ਜੀ ਸਾਡੇ ਪਠਾਨਕੋਟ ਦੇ ਵਿੱਚ ਖੇਡਣ ਨੂੰ ਬਹੁਤ ਜਗ੍ਹਾ ਉਪਲਬਧ ਹੈਗੀ ਹੈ ਅਤੇ ਇੱਥੇ ਗੌਰਮੈਂਟ ਸਕੂਲ ਕੋਲਜ ਹੈ ਉੱਥੇ ਮਲ ਕਿ ਸਟੇਡੀਅਮ ਬਣਿਆ ਹੋਇਆ ਫੁਟਬਾਲ ਸਟੇਡੀਅਮ ਹੈ ਕ੍ਰਿਕਟ ਸਟੇਡੀਅਮ ਹੈਗਾ ਆ ਅਕੈਡਮੀ ਵਗੈਰਾ ਆ ਉੱਥੇ ਬੱਚੇ ਸਪੋਰਟਸ ਖੇਡ ਕੇ ਬਾਹਰ ਖੇਡਣ ਜਾਂਦੇ ਆ ਇੰਟਰਨੈਸ਼ਨਲ ਨੈਸ਼ਨਲ ਗੇਮਾਂ ਖੇਡਦੇ ਨੇ ਰਣਜੀ ਟਰਾਫੀ ਵਗੈਰਾ ਇੱਥੋਂ ਪਲੇਅਰ ਬੜੇ ਗਏ ਨੇ ਨਿਕਲੇ ਨੇ ਫਿਰ ਇੱਥੇ ਪ ਪਠਾਨਕੋਟ ਕਲੱਬ ਹੈ ਉੱਥੇ ਸਵੀਮਿੰਗ ਦਾ ਵੀ ਪੂਰਾ ਸਿਖਾਇਆ ਜਾਂਦਾ ਹੈ ਟ੍ਰੇਨਿੰਗ ਦਿੱਤੀ ਜਾਂਦੀ ਹੈ ਗੌਰਮੈਂਟ ਇੱਥੇ ਐਸ ਡੀ ਸਕੂਲ ਹੈਗਾ ਆ ਐਸ ਡੀ ਸਕੂਲ ਦੇ ਵਿੱਚ ਬੈਡਮਿੰਟਨ ਦੀ ਗਰਾਊਂਡ ਬੈਡਮਿੰਟਨ ਹੋ ਗਿਆ ਫਿਰ ਫੁੱ ਫੁੱਟਬਾਲ ਵੀ ਵਗੈਰਾ ਕ੍ਰਿਕਟ ਵੀ ਉੱਥੇ ਖੇਡਿਆ ਜਾਂਦਾ ਹੈ ਹਾਕੀ ਦੀ ਵੀ ਪ੍ਰੈਕਟਿਸ ਕੀਤੀ ਜਾਂਦੀ ਆ ਉਹਦੀ ਅਕੈਡਮੀ ਆ ਉੱਥੇ ਉਹਦੀ ਵੀ ਸਾਰਾ ਕੁਝ ਸਹੂਲਤ ਦਿੱਤੀ ਗਈ ਹੈ ਉੱਥੇ ਕੋਚ ਵਗੈਰਾ ਵੀ ਰੱਖੇ ਹੋਏ ਨੇ ਜੋ ਤੁਹਾਨੂੰ ਟ੍ਰੇਨਿੰਗ ਦਿੰਦੇ ਨੇ ਫਸਟ ਐਡ ਵਗੈਰਾ ਦੀ ਪੂਰੀ ਉੱਥੇ ਉਹ ਅ ਉਪਲਬਧ ਹੈਗਾ ਆ ਕਿ ਬੱਚਿਆਂ ਨੂੰ ਚੋਟ ਲੱਗ ਜੇ ਕੁਛ ਵੀ ਹੈ ਸਾਰਾ ਉਹਦਾ ਦੇਖਿਆ ਜਾਂਦਾ ਹੈਗਾ ਆ ਸਵੀਮਿੰਗ ਦਾ ਹੈ ਫਿਰ ਇੱਥੇ ਹੋਰ ਵੀ ਕਈ ਐਸੇ ਕੇਂਦਰ ਨੇ ਜਿੱਥੇ ਦਾ ਪੂਲ ਟੇਬਲ ਨੇ ਪੂਲ ਟੇਬਲ ਦੇ ਵੀ ਗੇਮਾਂ ਖਿਡਾਈਆਂ ਜਾਂਦੀਆਂ ਟੂਰਨਾਮੈਂਟ ਹੁੰਦੇ ਨੇ ਟੂਰਨਾਮੈਂਟ ਦੇ ਵਿੱਚ ਬੜਾ ਕੁਝ ਸਿੱਖਿਆ ਵੀ ਜਾਂਦਾ ਅਤੇ ਸਿਖਾਇਆ ਵੀ ਜਾਂਦਾ ਆ ਬੜੇ ਬੱਚਿਆਂ ਨੂੰ ਕੁਝ ਸਿੱਖਣ ਨੂੰ ਮਿਲਦਾ ਆ ਦੂ ਬਾਹਰੋਂ ਟੀਮਾਂ ਆਉਂਦੀਆਂ ਨੇ ਇੱਥੇ ਟੂਰਨਾਮੈਂਟ ਖੇਡਣ ਵਾਸਤੇ ਕ੍ਰਿਕਟ ਦੀਆਂ ਵੀ ਇੱਥੇ ਫਿਰ ਭਲਵਾਨੀ ਦਾ ਬੜਾ ਵਧੀਆ ਕੁਸ਼ਤੀ ਦਾ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਗਰਮੀਆਂ ਦੇ ਵਿਚ ਆਹ ਇਸ ਲਈ ਤਾਂ ਸੀਜ਼ਨ ਚੱਲ ਰਿਹਾ ਆ ਕੁਸ਼ਤੀਆਂ ਦਾ